ਮੈਨੂੰ ਸਕੂਲ ਟਾਈਮ ਤੋਂ ਹੀ ਪੇਂਟਿੰਗ ਦਾ ਸ਼ੌਕ ਸੀ ਮੈਂ ਪਹਿਲੀ ਕਲਾਸ ਵਿੱਚ ਇੱਕ ਪੇਂਟਿੰਗ ਮੁਕਾਬਲੇ 'ਚ ਹਿੱਸਾ ਲਿਆ ਔਰ ਉਸਨੂੰ ਨੂੰ ਇੱਕ ਇਨਾਮ ਵੀ ਮਿਲਿਆ ਅਤੇ ਮਨ ਨੂੰ ਵੀ ਬੜੀ ਖੁਸ਼ੀ ਹੋਈ ਉਸ ਤੋਂ ਬਾਅਦ ਮੈਂ ਜਿਸ ਤਰ੍ਹਾਂ ਜਿਵੇਂ ਅਗਲੀਆਂ ਕਲਾਸਾਂ 'ਚ ਗਿਆ ਪੇਂਟਿੰਗ ਦੇ ਮੁਕਾਬਲੇ 'ਚ ਹਿੱਸੇ ਲੈਂਦਾ ਰਿਹਾ ਔਰ ਮੇਰਾ ਹੱਥ ਸਾਫ਼ ਹੋ ਗਿਆ ਔਰ ਮੈਂ ਕਾਫੀ ਸਕੈਚ ਬਣਾਏ ਜੋ ਅੱਜ ਵੀ ਸਕੂਲ ਆਫਿਸ 'ਚ ਲੱਗੇ ਹੋਏ ਨੇ ਔਰ ਮੈਨੂੰ ਕਈ ਇਨਾਮ ਵੀ ਪ੍ਰਾਪਤ ਹੋਏ ਔਰ ਅੱਜ ਵੀ ਕਿਤੇ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਸਕੈਚਿਸ ਜਾਂ ਕੁਛ ਨਾ ਕੁਛ ਵਧੀਆ ਸੀਨਰੀ ਬਣਾਉਂਦਾ ਹਾਂ ਅਤੇ ਮੈਨੂੰ ਪੇਂਟਿੰਗ ਕਰਨ ਸ਼ੌਕ ਅੱਜ ਵੀ ਹੈ ਅਤੇ ਅਗਾਂਹ ਵੀ ਰਹੇਗਾ